ਆਪਣੀ ਵੋਕਲ ਥਕਾਵਟ ਨੂੰ ਦੂਰ ਕਰਨ ਲਈ ਮੈਂ ਗੁਨਗੁਨੇ ਪਾਣੀ ਦਾ ਸੇਵਨ ਕਰਦੀ ਹਾਂ ਅਤੇ ਕੁਝ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਪਸੰਦ ਕਰਦੀ ਹਾਂ ਜਿਸ ਨਾਲ ਮੇਰੀ ਆਵਾਜ਼ ਵਿੱਚ ਮਿਠਾਸ ਹੋਵੇ ਅਤੇ ਆਪਣੀ ਆਵਾਜ਼ ਦੀ ਸੁਰੱਖਿਆ ਲਈ ਮੈਂ ਬਹੁਤ ਹੀ ਜ਼ਿਆਦਾ ਠੰਡੀਆਂ ਚੀਜ਼ਾਂ ਦਾ ਸੇਵਨ ਕਰਨ ਤੋਂ ਪ੍ਰਹੇਜ਼ ਕਰਦੀ ਹਾਂ ਅਤੇ ਅਜਿਹੀਆਂ ਚੀਜ਼ਾਂ ਤੋਂ ਦੂਰ ਹੀ ਰਹਿਣਾ ਦੂਰ ਰਹਿਣਾ ਪਸੰਦ ਕਰਨਾ ਚਾਹੁੰਦੀ ਹਾਂ ਜੋ ਕਿ ਮੇਰੀ ਆਵਾਜ਼ ਲਈ ਖ਼ਰਾਬ ਹੋਣ